ਹਾਂ ਜੇ ਅੱਜ ਦੇ ਟੈਮ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਦਾ ਸਾਰਾ ਦਿਨ ਦਫ਼ਤਰ ਦੇ ਵਿੱਚ ਨਿਕਲ ਜਾਂਦਾ ਅਤੇ ਮੈਂ ਆਪਦਾ ਜੋ ਮੇਰਾ ਸ਼ਡਿਊਲ ਹੈ ਮੈਂ ਸਵੇਰੇ ਜਲਦੀ ਉੱਠਦਾ ਅਤੇ ਗਰਾਉਂਡ ਜਾਂਦਾ ਓਥੇ ਰਨਿੰਗ ਕਰਦਾ ਅਤੇ ਉਸ ਤੋਂ ਬਾਅਦ ਐਕਸਰਸਾਈਜ਼ ਕਰਦਾ ਜਿਹਦੇ ਵਿੱਚ ਪੁਛ ਅੱਪ ਜਾਂ ਉਹ ਮਾਰਦਾ ਜਾਂ ਬੀਮ ਲਾਉਂਦਾ ਹੈਗਾ ਅਤੇ ਉਸ ਤੋਂ ਬਾਅਦ ਸਟਰੈਚਿੰਗ ਵੀ ਕਰਦਾ ਅਤੇ ਸਟ੍ਰੈਚਿੰਗ ਕਰਨ ਦੇ ਨਾਲ ਸਰੀਰ ਦੇ ਵਿੱਚ ਅੱਛੀ ਫਲੈਕਸਿਬਿਲਟੀ ਆਉਂਦੀ ਆ ਅਤੇ ਰਨਿੰਗ ਕਰਨ ਦੇ ਨਾਲ ਮੇਰਾ ਸਟੈਮਿਨਾ ਵਧੀਆ ਬਣਦਾ ਅਤੇ ਬਾਕੀ ਸਾਰੇ ਦੇ ਸਾਰੇ ਸਰੀਰ ਦੀ ਬਹੁਤ ਵਧੀਆ ਐਕਸਰਸਾਈਜ ਹੁੰਦੀ ਆ ਰਨਿੰਗ ਮੈਨੂੰ ਇੱਦਾਂ ਲੱਗਦਾ ਵੀ ਰਨਿੰਗ ਤੋਂ ਵਧੀਆ ਐਕਸਰਸਾਈਜ ਕੋਈ ਹੋ ਹੀ ਨਹੀਂ ਸਕਦੀ ਰਨਿੰਗ ਦੇ ਵਿੱਚ ਸਾਰੇ ਦੇ ਸਾਰੇ ਸਰੀਰ ਦੀ ਬਹੁਤ ਵਧੀਆ ਤਰੀਕੇ ਨਾਲ ਐਕਸਰਸਾਈਜ ਹੁੰਦੀ ਆ ਅਤੇ ਸਵੇਰੇ ਜਲਦੀ ਉੱਠਣ ਦੇ ਨਾਲ ਵੀ ਆਪਣੀ ਜੋ ਹੈਲਥ ਆ ਜੋ ਸਵੇਰ ਦਾ ਮਾਹੌਲ ਹੁੰਦਾ ਜੋ ਸਵੇਰ ਦਾ ਮੌਸਮ ਹੁੰਦਾ ਆਪਣੀ ਆਪਣੀ ਜ਼ਿੰਦਗੀ ਦਾ ਜ਼ਿੰਦਗੀ ਵਾਸਤੇ ਬਹੁਤ ਵਧੀਆ ਹੁੰਦਾ ਅਤੇ ਇਹਦੇ ਨਾਲ ਆਪਣੀ ਸਿਹਤ ਬਹੁਤ ਵਧੀਆ ਰਹਿੰਦੀ ਆ ਅਤੇ ਮੇਰੇ ਹਿਸਾਬ ਇਹ ਚੀਜ਼ ਬਹੁਤ ਜ਼ਰੂਰੀ ਆ ਹਰ ਇੱਕ ਨੂੰ ਆਪਣੇ ਸ਼ਡਿਊਲ ਦੇ ਵਿੱਚ ਸਵੇਰੇ ਜਲਦੀ ਉੱਠਣਾ ਚਾਹੀਦਾ ਰਨਿੰਗ ਵੋ ਰਨਿੰਗ ਕਰਨੀ ਚਾਹੀਦੀ ਆ ਜਿੰਮ ਜਾਂ ਸਵੀਮਿੰਗ ਜਾਂ ਅਲੱਗ ਅਲੱਗ ਤਰ੍ਹਾਂ ਦੀਆਂ ਜੋ ਵੀ ਹੈਬਿਟਸ ਹੈਗੀਆਂ ਨੇ ਆਪਣੀ ਸਿਹਤ ਨੂੰ ਤਵੱਜੋ ਦੇਣੀ ਚਾਹੀਦੀ ਆ ਅਤੇ ਇਹਦੇ ਨਾਲ ਸਰੀਰ ਸਿਹਤਮੰਦ ਵੀ ਰਹਿੰਦਾ ਅਤੇ ਪਲੱਸ ਤੁਸੀਂ ਜੋ ਬਿਮਾਰੀਆਂ ਨੇ ਇਨ੍ਹਾਂ ਤੋਂ ਬਚੇ ਰਹਿੰਦੇ ਹੋ ਤੁਹਾਡਾ ਜੋ ਬਿਮਾਰੀਆਂ ਨਾਲ ਲੜਨ ਦੀ ਜੋ ਤੁਹਾਡੀ ਸਮਰੱਥਾ ਹੁੰਦੀ ਆ ਉਹ ਵਧਦੀ ਆ ਤੁਹਾਡਾ ਅਮੀਉਨ ਸਿਸਟਮ ਹੈ ਨਾ ਉਹ ਵੀ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਹੈਗਾ ਅਤੇ ਵਧੀਆ ਡਾਈਟ ਫੋਲੋ ਕਰਨੀ ਜ਼ਰੂਰੀ ਹੈ ਅਤੇ ਜੇ ਸਰੀਰ ਸਿਹਤਮੰਦ ਹੈ ਤੰਦਰੁਸਤ ਹੈ ਤਾਂ ਇਹਦੇ ਪਿੱਛੇ ਕਿਤੇ ਨਾ ਕਿਤੇ ਐਕਸਰਸਾਈਜ਼ ਦਾ ਜਾਂ ਜੋ ਤੁਸੀਂ ਵਰਕਆਊਟ ਕਰਦੇ ਹੋ ਡੇਲੀ ਉਹਦਾ ਬਹੁਤ ਵੱਡਾ ਹੱਥ ਹੁੰਦਾ ਅਤੇ ਮੈਂ ਆਪਦੀ ਲਾਈਫ ਦੇ ਵਿੱਚ ਇਹ ਸ਼ਡਿਊਲ ਕਦੇ ਵੀ ਸਕਿੱਪ ਨਹੀਂ ਕੀਤਾ ਡੇਲੀ ਮੇਰਾ ਵੋਕ 'ਤੇ ਜਾਣਾ ਸਵੀਮਿੰਗ ਕਰਨੀ ਸਟ੍ਰੈਚਿੰਗ ਕਰਨੀ ਰਨਿੰਗ ਕਰਨੀ ਪੁਸ਼ ਅੱਪ ਲਾਉਣੇ ਬੀਮ ਲਾਉਣੇ ਸਵੇਰੇ ਜਲਦੀ ਉੱਠਣਾ ਇਹ ਮੇਰਾ ਬਹੁਤ ਵਧੀਆ ਸ਼ਡਿਊਲ ਹੈ ਅੱਜ ਤੱਕ ਕਦੇ ਵੀ ਮੈਂ ਇਹਨੂੰ ਬ੍ਰੇਕ ਨਹੀਂ ਕੀਤਾ